ਪੰਛੀਆਂ ਦੇ ਉੱਡਣ ਦਾ ਮੁਕਾਬਲਾ ਇੱਕ ਵਿਸ਼ੇਸ਼ ਅਤੇ ਦਿਲਚਸਪ ਦ੍ਰਿਸ਼ ਹੈ ਜੋ ਕੁਛ ਖਾਸ ਕਿਸਮਾਂ ਦੇ ਪੰਛੀਆਂ ਵਿੱਚ ਦੇਖਣ ਨੂੰ ਮਿਲਦਾ ਹੈ ਇਹ ਮੁਕਾਬਲਾ ਕਈ ਪ੍ਰਕਾਰ ਦੇ ਹੋ ਸਕਦੇ ਹਨ ਪਰ ਆਮ ਤੌਰ 'ਤੇ ਇਹ ਪੰਛੀਆਂ ਦੀ ਉੜਾਨ ਦੀ ਦ੍ਰਿਸ਼ਟੀ ਵਿੱਚ ਹੁੰਦਾ ਹੈ ਜਿੱਥੇ ਉਹ ਇੱਕ ਦੂਜੇ ਦੇ ਨਾਲ ਰੇਸ ਕਰਦੇ ਹਨ ਜਾਂ ਉਚਾਈ ਵਿੱਚ ਜਾਂ ਵਿਸ਼ੇਸ਼ ਦਿਸ਼ਾ ਵਿੱਚ ਦੌੜਦੇ ਹਨ ਕੁਛ ਪ੍ਰਸਿੱਧ ਪੰਛੀਆਂ ਜਿਵੇਂ ਕਿ ਹਕੀਜ ਸਵਾਲੋਜ ਜਾਂ ਕੁਛ ਪ੍ਰਤੀਕਿਰਿਆ ਤੱਤਾਂ ਨੂੰ ਮਦਦ ਕਰਦੀਆਂ ਕਿਸਮਾਂ ਇਹ ਮੁਕਾਬਲੇ ਦੇਖੇ ਜਾਂਦੇ ਹਨ ਉੱਡਣ ਦਾ ਮੁਕਾਬਲਾ ਜਿੱਤ ਅਤੇ ਹਾਰ ਜਿੱਤ ਅਤੇ ਹਾਰ ਦਾ ਤ੍ਰਿੰਜਨ ਉੱਡਣ ਦਾ ਮੁਕਾਬਲਾ ਸਿੱਧਾ ਪੰਛੀ ਦੀ ਦ੍ਰਿਸ਼ਟੀ ਅਤੇ ਤਾਕਤ ਨਾਲ ਸੰਬੰਧਿਤ ਹੈ ਉਸ ਪੰਛੀ ਜਿੱਤ ਉਸ ਪੰਛੀ ਦੀ ਹੋਏਗੀ ਜੋ ਜ਼ਿਆਦਾ ਤੇਜ਼ੀ ਨਾਲ ਜਾਂ ਸਹੀ ਦਿਸ਼ਾ ਵਿੱਚ ਉੱਡ ਸਕਦਾ ਹੈ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਿਸ ਪੰਛੀ ਦਾ ਫਿਟਨੈਸ ਲੈਵਲ ਵਧੀਆ ਹੈ ਜਿਵੇਂ ਕਿ ਉਹ ਵੱਧ ਸਮੇਂ ਤੱਕ ਉੱਡ ਸਕਦਾ ਹੈ ਜਾਂ ਜਿਸ ਦਾ ਪੰਛੀ ਜ਼ਿਆਦਾ ਆਲਸੀ ਜਾਂ ਹਲਕਾ ਹੈ ਸਹੀ ਦਿਸ਼ਾ 'ਤੇ ਉੱਡਣਾ

ਪ ਹਰ ਪੰਛੀ ਉਹ ਹੋ ਸਕਦਾ ਹੈ ਜੋ ਗਲਤ ਦਿਸ਼ਾ ਵਿੱਚ ਜਾਂ ਘੱਟ ਹਾਈਟ 'ਤੇ ਉੱਡਣ ਦੀ ਕੋਸ਼ਿਸ਼ ਕਰਦਾ ਹੈ ਅਕਸਰ ਸੈਲਫ ਪ੍ਰਤਿਕ੍ਰਿਆਵਾਂ ਅਤੇ ਸਹੀ ਰਸਤੇ ਅਤੇ ਹਵਾ ਦੇ ਪੈਟਰਨ ਦੀ ਸਮਝ ਇਸ ਕਿਸਮ ਦੇ ਮੁਕਾਬਲੇ ਵਿੱਚ ਜ਼ਰੂਰੀ ਹੁੰਦੀ ਹੈ ਸਮੇਂ ਅਤੇ ਸਥਿਤੀ ਮੁਕਾਬਲਾ ਸ਼ੁਰੂ ਹੋਣ ਤੋਂ ਅੰਤ ਤੱਕ ਸਥਿਤੀ ਅਤੇ ਹਵਾ ਦੇ ਮਾਹੌਲ 'ਤੇ ਵੀ ਨਿਰਭਰ ਕਰਦਾ ਹੈ ਹਵਾ ਦੀ ਦਿਸ਼ਾ ਅਤੇ ਗਤੀ ਇਸੇ ਤੱਕ ਕਿ ਮੌਸਮ ਵੀ ਮੁਕਾਬਲੇ ਨੂੰ ਪ੍ਰਭਾਵਿਤ ਕਰਦੇ ਹਨ ਚੰਗੀ ਹਵਾ ਵਿੱਚ ਪੰਛੀਆਂ ਜ਼ਿਆਦਾ ਦੂਰ ਜਾਂ ਤੇਜ਼ੀ ਨਾਲ ਉੱਡ ਸਕਦੇ ਹਨ ਜਿਸ ਨਾਲ ਉਹ ਜਿੱਤ ਜਾਂ ਹਾਰ ਹੋ ਸਕਦੀ ਹੈ ਉੱਡਣ ਵਾਲੇ ਪ ਪੰਛੀਆਂ ਦੀਆਂ ਖਾਸ ਖੂਬੀਆਂ ਸਵਾਲੋ ਸਵਾਲੋਜ ਆਮ ਤੌਰ 'ਤੇ ਆਪਣੇ ਤੇਜ਼ੀ ਨਾਲ ਉੱਡਣ ਲਈ ਜਾਣੇ ਜਾਂਦੇ ਹਨ ਉਹ ਇੱਕ ਦੂਜੇ ਨਾਲ ਟੀਮ ਬਣਾ ਕੇ ਤੇਜ਼ੀ ਨਾਲ ਉੱਡ ਸਕਦੇ ਹਨ ਅਤੇ ਕਈ ਵਾਰੀ ਆਪਣੇ ਲਗਾਤਾਰ ਘੁੰਮਣ ਵਾਲੇ ਰੂਟਾਂ ਨਾਲ ਹੋਰ ਪੰਛੀਆਂ ਨੂੰ ਹਰਾ ਸਕਦੇ ਹਨ ਹਾਕੀਜ ਹਾਕੀਜ ਜੋ ਕਿ ਉਚਾਈ 'ਤੇ ਉੱਡਣ ਵਾਲੇ ਸ਼ਿਕਾਰੀ ਪੰਛੀ ਹਨ ਉਹ ਖੂਬਸੂਰਤੀ ਨਾਲ ਅਤੇ ਬੜੀ ਉਚਾਈ 'ਤੇ ਉੱਡ ਸਕਦੇ ਹਨ ਉਹ ਆਪਣੇ ਸਿਕਾਰ ਦੇ ਲਈ ਪ੍ਰਸਿੱਧ ਹਨ ਅਤੇ ਕੁਛ ਪ੍ਰਕਾਰ ਦੇ ਮੁਕਾਬਲਿਆਂ ਵਿੱਚ ਉਹ ਆਪਣੇ ਅਸਾਲ ਬਲ ਅਤੇ ਫਲਾਈਟ ਤਕਨੀਕ ਨਾਲ ਵੀ ਜਿੱਤ ਸਕਦੇ ਹਨ ਸਿੱਖਣ ਅਤੇ ਮੁਕਾਬਲਾ ਕੀ ਕੁਛ ਜ਼ਿੰਦਗੀ ਦੇ ਆਧਾਰ ਇਸ ਤਰ੍ਹਾਂ ਦੇ ਮੁਕਾਬਲੇ ਕੁਛ ਹਾਲਾਤ ਵਿੱਚ ਪੰਛੀਆਂ ਦੇ ਕੁਦਰਤੀ ਯੋਗਤਾ ਅਤੇ ਸਰਗਰਮੀ ਨੂੰ ਦਰਸਾਉਂਦੇ ਹਨ ਜਿਸ ਵਿੱਚ ਜਿੱਤ ਅਤੇ ਹਾਰ ਮੌਸਮ ਹਵਾ ਸੇਧ ਅਤੇ ਸੰਘਰਸ਼ ਦੇ ਆਧਾਰ 'ਤੇ ਨਿਰਭਰ ਕਰਦੇ ਹਨ